ਕਿਸਾਨਾਂ ਨੂੰ ਆਪਣੇ ਜਾਨਵਰਾਂ ਬਾਰੇ ਜਾਗਰੂਕ ਰਹਿਣਾ ਚਾਹੀਦਾ ਉਹਨਾਂ ਨੂੰ ਆਪਣੇ ਜਾਨਵਰਾਂ ਦਾ ਬਹੁਤ ਅੱਛੇ ਤਰ੍ਹਾਂ ਧਿਆਨ ਰੱਖਣਾ ਚਾਹੀਦਾ ਸਮੇਂ ਸਮੇਂ 'ਤੇ ਉਹਨਾਂ ਨੂੰ ਇੰਜੈਕਸ਼ਨ ਲਗਵਾਉਣੇ ਚਾਹੀਦੇ ਆ ਔਰ ਉਹਨਾਂ ਦੀ ਮਤਲਬ ਗਰੀਨ ਹਰ ਇੱਕ ਕੱਖ ਪਾਉਣੀ ਚਾਹੀਦੀ ਉਹਨਾਂ ਨੂੰ ਜ਼ਿਆਦਾਤਰ ਔਰ ਬਿਮਾਰੀਆਂ ਤੋਂ ਬਚਾਉਣ ਵਾਸਤੇ ਇ ਟੀਕੇ ਲਗਵਾਉਣੇ ਚਾਹੀਦੇ ਹਨ ਦਵਾਈਆਂ ਦੇਣੀਆਂ ਚਾਹੀਦੀਆਂ ਹਨ ਔਰ ਸਮੇਂ ਸਮੇਂ 'ਤੇ ਉਹਨਾਂ ਨੂੰ ਉਹਨਾਂ ਦੀ ਜਾਂਚ ਕਰਵਾਉਂਦੇ ਰਹਿਣਾ ਚਾਹੀਦਾ ਜਿਸ ਤਰ੍ਹਾਂ ਪਿੱਛੇ ਜਾਂ ਗਾਵਾਂ ਨੂੰ ਬਹੁਤ ਬਿਮਾਰੀ ਚੱਲੀ ਸੀ ਉਸ ਦੇ ਨਾਲ਼ ਦੁੱਧ ਦੇ ਵੀ ਬਹੁਤ ਨੁਕਸਾਨ ਹੋਇਆ ਸੀ ਬਹੁਤ ਡੰਗਰ ਮਰ ਗਏ ਸੀ ਆਪਾਂ ਨੂੰ ਆਪਣੇ ਵ ਡੰਗਰ ਵੱਛਿਆਂ ਦਾ ਬਹੁਤ ਧਿਆਨ ਰੱਖਣਾ ਚਾਹੀਦਾ ਔਰ ਉਹਨਾਂ ਦਾ ਸਮੇਂ ਸਮੇਂ 'ਤੇ ਇਲਾਜ ਕਰਵਾਉਣਾ ਚਾਹੀਦਾ ਔਰ ਉਹਨਾਂ ਨੂੰ ਅੱਛੀਆਂ ਤੋਂ ਅੱਛੀਆਂ ਦਵਾਈਆਂ ਦਿਲਾਣੀਆਂ ਚਾਹੀਦੀਆਂ ਹਨ ਉਸ ਤੋਂ ਇਲਾਵਾ ਉਹਨਾਂ ਨੂੰ ਖਾਣੇ ਨੂੰ ਅੱਛੇ ਵਾਲ਼ਾ ਹਰਾ ਮਤਲਬ ਹਰੇ ਕੱਖ ਔਰ ਦਾਣਾ ਜੋ ਦਾਣਾ ਹੁੰਦਾ ਉਹ ਬਹੁਤ ਅੱਛੀ ਕੁਆਲਿਟੀ ਦਾ ਲੈਣਾ ਚਾਹੀਦਾ